ਭਾਰਤ ਵਿੱਚ ਬਹੁਤ ਰਾਜੇ ਹੋਏ ਨੇ ਅਤੇ ਮੇਰੇ ਮਨਪਸੰਦ ਦੇ ਉਹਨਾਂ ਵਿੱਚੋਂ ਨੇ ਖਾਲਸਾ ਪੰਥ ਦੀ ਸਾਜਨਾ ਕਰਨ ਵਾਲੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਚਾਰ ਪੁੱਤਰ ਸੀ ਜੋ ਕਿ ਉਹਨਾਂ ਨੇ ਸਰਬੰਸ ਤੋਂ ਵਾਰ ਦਿੱਤੇ ਉਹਨਾਂ ਨੇ ਸ਼੍ਰੀ ਚਮਕੌਰ ਸਾਹਿਬ ਵਿੱਚ ਜੰਗ ਹੋਈ ਤਾਂ ਉਹਨਾਂ ਦੇ ਦੋ ਵੱਡੇ ਬੇਟੇ ਉੱਥੇ ਸ਼ਹੀਦੀਆਂ ਸ਼ਹੀਦੀਆਂ ਪਾ ਗਏ ਅਤੇ ਉਹਨਾਂ ਦੇ ਛੋਟੇ ਬ ਬੇਟੇ ਦੋ ਸ਼੍ਰੀ ਫਤਿਹਗੜ੍ਹ ਸਾਹਿਬ ਨੀਹਾਂ ਵਿੱਚ ਚਿਣਵਾਏ ਗਏ